ਹਾਂਜੀ ਅਸੀਂ ਸਿੱਧੀ ਅੱਗ 'ਤੇ ਚੁੱਲ੍ਹੇ 'ਤੇ ਖਾਣਾ ਬਣਾਇਆ ਹੈ ਜਿਵੇਂ ਕਿ ਚਾਹ ਰੋਟੀ ਅਤੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਹਨ ਇਹ ਇੰਡਕਸ਼ਨ ਤੋਂ ਬਹੁਤ ਜ਼ਿਆਦਾ ਵੱਖਰਾ ਹੈ ਇਹ ਸਿੱਧੀ ਅੱਗ 'ਤੇ ਕੁਝ ਵੀ ਬਣਾਉਣਾ ਹੋਵੇ ਤਾਂ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਅਤੇ ਇੰਡੋਕਸ਼ਨ ਗੈਸ 'ਤੇ ਸਮਾਂ ਜ਼ਿਆਦਾ ਨਹੀਂ ਲੱਗਦਾ ਪਰ ਇਹਨਾਂ ਦੋਨਾਂ ਦਾ ਬਹੁਤ ਜ਼ਿਆਦਾ ਫਰਕ ਹੈ ਇਸ ਕਰਕੇ ਸਿੱਧੀ ਅੱਗ 'ਤੇ ਵੀ ਖਾਣਾ ਬਣਾਇਆ ਜਾ ਸਕਦਾ ਹੈ ਪਰ ਅੱਜ ਕੱਲ੍ਹ ਮੌਡਰਨ ਜ਼ਮਾਨਾ ਹੋਣ ਕਰਕੇ ਇੰਨਾਂ ਸਮਾਂ ਨਹੀਂ ਹੈ ਕਿ ਉਹ ਸਿੱਧੀ ਅੱਗ 'ਤੇ ਕੁਝ ਬਣਾ ਸਕਣ ਇੰਡਕਸ਼ਨ ਤੋਂ ਇਹ ਬਹੁਤ ਜ਼ਿਆਦਾ ਵੱਖਰਾ ਇੰਡਕਸ਼ਨ ਗੈਸ ਤੋਂ ਅਸੀਂ ਸਮਾਂ ਵੀ ਬਚਾ ਸਕਦੇ ਹਾਂ ਅਤੇ ਜਲਦੀ ਤੋਂ ਜਲਦੀ ਖਾਣਾ ਜਾਂ ਕੁਛ ਹੋਰ ਬਣਾ ਸਕਦੇ ਹਾਂ ਇਹ ਚੀਜ਼ ਹੈ ਜੀ